ਸਾਡੇ ਸੱਭਿਆਚਾਰਕ ਰਾਜ ਦੀ ਪਹਿਚਾਣ ਅਸੀਂ ਪੰਜਾਬੀ ਹਾਂ ਸਾਡਾ ਅਸੀਂ ਰਹਿਣ ਵਾਲੇ ਪੰਜਾਬ ਤੋਂ ਹਾਂ ਸਾਨੂੰ ਸਾਡੀ ਪੰਜਾਬੀ ਭਾਸ਼ਾ ਮਾਂ ਬੋਲੀ ਨਾਲ ਮਾਂ ਬੋਲੀ 'ਤੇ ਬਹੁਤ ਮਾਣ ਹੈ ਸਾਡੀ ਪੰਜਾਬੀ ਭਾਸ਼ਾ ਆਦਿ ਪਹਿਚਾਣ ਹੈ ਕਿ ਜਦ ਵੀ ਸਾਡੇ ਕੋਈ ਪੁਰਾਣੇ ਸਮੇਂ ਦੇ ਜਾਂ ਸਾਡੇ ਮਤਲਬ ਪੰਜਾਬ ਦੇ ਇੱਕ ਸੱਭਿਆਚਾਰਕ ਹੈ ਲੋਕ ਗੀਤ ਬੋਲੀਆਂ ਭੰਗੜਾ ਜੋ ਵੀ ਮਤਲਬ ਪੰਜਾਬੀ ਭਾਸ਼ਾ ਦਾ ਹੈ ਇਸ ਨੂੰ ਅਸੀਂ ਹਿੰਦੀ ਜਾਂ ਇੰਗਲਿਸ਼ ਦੇ ਵਿੱਚ ਨਹੀਂ ਵਰਤੋਂ ਕਰ ਸਕਦੇ ਜਿਸ ਦਾ ਕੋਈ ਮੀਨਿੰਗ ਨਹੀਂ ਹੈ ਇਹ ਸਿਰਫ ਪੰਜਾਬੀ ਮਾਂ ਬੋਲੀ ਦੀ ਵਰਤੋਂ ਵਿੱਚ ਹੀ ਬਣਿਆ ਹੈ ਪੰਜਾਬੀ ਲੋਕ ਗੀਤ ਗਿੱਦਾ ਬੋਲੀਆਂ ਇਹ ਸਾਡੀ ਪੰਜਾਬੀ ਮਾਂ ਬੋਲੀ ਦੀ ਪਹਿਚਾਣ ਹੈ ਜੋ ਅਸੀਂ ਪੰਜਾਬੀ ਵਿੱਚ ਹੀ ਵਰਤੋਂ ਕਰ ਸਕਦੇ ਹਾਂ ਇਸ ਨੂੰ ਹਿੰਦੀ ਜਾਂ ਇੰਗਲਿਸ਼ ਦੇ ਵਿੱਚ ਕਨਵਰਟ ਨਹੀਂ ਕਰ ਸਕਦੇ ਸਾਡੀ ਪੰਜਾਬੀ ਮਾਂ ਬੋਲੀ 'ਤੇ ਸਾਨੂੰ ਬਹੁਤ ਹੀ ਮਾਣ ਹੈ ਪੰਜਾਬੀ ਮਾਂ ਬੋਲੀ ਇੱਕ ਬਹੁਤ ਹੀ ਅਹਿਮ ਭੂਮਿਕਾ ਨਿਭਾਉਂਦੀ ਹੈ ਜਿਸ ਦੇ ਵਿੱਚ ਮਤਲਬ ਸਾਡੀ ਪੰਜਾਬੀ ਭਾਸ਼ਾ ਇੱਕ ਬਹੁਤ ਹੀ ਸਰਲ ਅਤੇ ਬਹੁਤ ਹੀ ਚੰਗੀ ਭਾਸ਼ਾ ਹੈ ਜਿਸ ਨੂੰ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਬਿਰਾਜਿਆ ਜਾ ਸਕਦਾ ਹੈ ਬੋਲਿਆ ਜਾ ਸਕਦਾ ਹੈ ਸਾਡੀ ਪੰਜਾਬੀ ਭਾਸ਼ਾ ਪੰਜਾਬੀ ਵਿੱਚ ਅਸੀਂ ਗਿੱਧੇ ਬੋਲੀਆਂ ਅਤੇ ਹੋਰ ਵੀ ਬਹੁਤ ਭੰਗੜੇ ਹਨ ਬਹੁਤ ਗੀਤ ਹਨ ਜੋ ਅਸੀਂ ਪੰਜਾਬੀ ਵਿੱਚ ਹੀ ਕਰ ਸਕਦੇ ਹਾਂ ਪੰਜਾਬੀ ਭਾਸ਼ਾ ਦੇ ਵਿੱਚ ਹੀ ਕਰ ਸਕਦੇ ਹਾਂ ਜਿਹਨਾਂ ਨੂੰ ਅਸੀਂ ਹੋਰ ਭਾਸ਼ਾਵਾਂ ਦੇ ਵਿੱਚ ਕਨਵਰਟ ਨਹੀਂ ਕਰ ਸਕਦੇ ਜਿਹਨਾਂ ਦਾ ਕੋਈ ਮੀਨਿੰਗ ਨਹੀਂ ਹੁੰਦਾ ਅਸੀਂ ਪੰਜਾਬੀ ਜੋ ਵੀ ਪੰਜਾਬੀ ਦੀਆਂ ਚੀਜ਼ਾਂ ਹਨ ਪੰਜਾਬੀ ਮਾਂ ਬੋਲੀ ਦੇ ਜੋ ਵੀ ਵਰਤੋਂ ਜੋ ਵੀ ਸ਼ਬਦ ਹਨ ਉਹ ਪੰਜਾਬੀ ਵਿੱਚ ਹੀ ਰੱਖ ਸਕਦੇ ਹਾਂ ਜਿਹਨਾਂ ਨੂੰ ਅਸੀਂ ਹੋਰ ਭਾਸ਼ਾਵਾਂ ਦੇ ਵਿੱਚ ਕਨਵਰਟ ਨਹੀਂ ਕਰ ਸਕਦੇ ਜਿਹਨਾਂ ਦਾ ਹੋਰ ਭਾਸ਼ਾਵਾਂ ਵਿੱਚ ਕਨਵਰਟ ਕਰਨ ਕਾਰਨ ਉਹਨਾਂ ਦਾ ਕੋਈ ਮੀਨਿੰਗ ਨਹੀਂ ਨਿਕਲਦਾ ਇਸ ਲਈ ਸਾਨੂੰ ਸਾਡੀ ਪੰਜਾਬੀ ਮਾਂ ਬੋਲੀ 'ਤੇ ਬਹੁਤ ਮਾਣ ਹੈ